ਸਾਡੇ ਧਰਮ ਦਾ ਅਧਿਐਨ ਕਰਨਾ ਸਾਡੇ ਸਕੂਲ ਦੇ ਪਾਠਕ੍ਰਮ ਦਾ ਇੱਕ ਮਹੱਤਵਪੂਰਨ ਅਤੇ ਮੁੱਢਲਾ ਹਿੱਸਾ ਹੈ ਇਹ ਸਾਡੇ ਸਮਾਜ ਦੇ ਵਿੱਚ ਸਾਨੂੰ ਮੇਲ ਜੋਲ ਉੱਠਣ ਬੈਠਣ ਅਤੇ ਮਿਲ ਜੁਲ ਕੇ ਰਹਿਣ ਦਾ ਸੁਨੇਹਾ ਦਿੰਦਾ ਹੈ ਇੱਕ ਦੂਜੇ ਨਾਲ ਮਿਲਵਰਤਨ ਦਾ ਵੀ ਸੁਨੇਹਾ ਦਿੰਦਾ ਹੈ ਇੱਕ ਦੂਜੇ ਦੇ ਕੰਮ ਆਉਣਾ ਕੰਮ ਆਉਣਾ ਅਤੇ ਉਸਦਾ ਨਿੱਜੀ ਕੰਮ ਵੀ ਕਰਨਾ ਆਦਿ ਦਾ ਸੁਨੇਹਾ ਦਿੰਦਾ ਹੈ